ਸਾਨੂੰ ਰਸਮੀ ਕਾਰਵਾਈ ਕਰਨ ਦੀ ਲੋੜ ਹੈ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਪੂਜਾ ਪਾਠ ਜਾਂ ਜੋ ਵੀ ਹੈ ਅਗਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਮੋਟੀ ਪੂੰਜੀ ਦੀ ਲੋੜ ਹੁੰਦੀ ਹੈ ਜਿਸ ਕਰਕੇ ਅਸੀਂ ਜਮੀਨ ਖਰੀਦ ਸਕੀਏ ਅਤੇ ਉਹਦੇ ਉੱਤੇ ਉਹ ਬਣਾ ਸਕੀਏ ਜਗ੍ਹਾ ਬਣਾ ਸਕੀਏ ਨੀਹਾਂ ਖੜੀਆਂ ਕਰ ਸਕੀਏ ਉਹਦੇ ਉੱਤੇ ਲੈਂਟਰ ਪਾ ਸਕੀਏ ਤਾਂ ਕਿ ਜਿਸ ਤਰੀਕੇ ਨਾਲ ਉਹਦੇ ਉੱਤੇ ਕੋਈ ਛੋਟੀ ਬਿਲਡਿੰਗ ਖੜੀ ਹੋ ਸਕੇ ਉਸ ਤੋਂ ਬਾਅਦ ਸਾਨੂੰ ਇਕੁਪਮੈਂਟਸ ਦੀ ਲੋੜ ਹੁੰਦੀ ਹੈ ਮਸ਼ੀਨਾਂ ਵਗੈਰਾ ਇਸ ਕਰਕੇ ਫੰਡ ਵੀ ਕਾਰੋਬਾਰ ਸ਼ੁਰੂ ਕਰਨ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ਉਸ ਤੋਂ ਬਾਅਦ ਪੂਜਾ ਪਾਠ ਜਾਂ ਜਿਵੇਂ ਵੀ ਹੈ ਕਾਗਜ਼ੀ ਕਾਰਵਾਈ ਕਰਕੇ ਸਰਕਾਰ ਤੋਂ ਅਪਰੂਵਲ ਲੈਣੀ ਹੁੰਦੀ ਹੈ ਵੀ ਕੀ ਮੈਂ ਆਪਣਾ ਇਹ ਕਾਰੋਬਾਰ ਸ਼ੁਰੂ ਕਰ ਸਕਦਾ ਹਾਂ